ਅੱਜ ਕੱਲ੍ਹ ਲੋਕ ਖੇਤੀਬਾੜੀ ਵਿੱਚ ਨਹੀਂ ਜਾਣਾ ਚਾਹੁੰਦੇ ਖੇਤੀਬਾੜੀ ਨਹੀਂ ਕਰਨਾ ਚਾਹੁੰਦੇ ਇਸ ਦੇ ਪਿੱਛੇ ਕਾਰਣ ਇਹ ਹੈ ਕਿ ਲੋਕ ਆਪਣੇ ਆਪ ਨੂੰ ਸੌਖਾ ਰੱਖਣਾ ਚਾਹੁੰਦੇ ਨੇ ਘੱਟ ਮਿਹਨਤ ਦੇ ਨਾਲ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਨੇ ਖੇਤੀਬਾੜੀ ਇੱਕ ਅਜਿਹਾ ਕਿੱਤਾ ਹੈ ਜਿੱਥੇ ਵਿਅਕਤੀ ਨੂੰ ਆਪਣੇ ਪੂਰੇ ਜੀ ਜਾਨ ਲਾ ਕੇ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਕਿਤੇ ਜਾ ਕੇ ਕਮਾਈ ਹੁੰਦੀ ਹੈ ਕਿਤੇ ਜਾ ਕੇ ਫਸਲਾਂ ਉੱਗਦੀਆਂ ਹਨ ਤਾਂ ਖੇਤੀ ਕਰਨ ਲਈ ਕੁਝ ਸਾਧਨਾਂ ਦੀ ਵੀ ਜ਼ਰੂਰਤ ਪੈਂਦੀ ਹੈ ਜਿਵੇਂ ਟਰੈਕਟਰ ਹੱਲ ਵਗੈਰਾ ਤਾਂ ਇਹ ਸਾਧਨਾਂ ਤਾਂ ਪੈਸਾ ਵੀ ਕਾਫ਼ੀ ਲੱਗ ਜਾਂਦਾ ਹੈ ਜੇ ਖੇਤੀਬਾੜੀ ਦਾ ਇਕੱਲਾ ਇਕੱਲਾ ਸਾਧਨ ਦੇਖਿਆ ਜਾਵੇ ਤਾਂ ਕਾਫ਼ੀ ਖਰਚ ਕਿਸਾਨਾਂ ਨੂੰ ਆ ਜਾਂਦਾ ਹੈ ਇਸ ਕਾਰਣ ਲੋਕ ਇਹਨਾਂ ਸਾਧਨਾਂ ਦਾ ਖਰਚਾ ਨਹੀਂ ਉਠਾਉਣਾ ਚਾਹੁੰਦੇ ਅਤੇ ਦੂਜੀ ਗੱਲ ਲੋਕ ਆਪਣੀ ਜਾਨ ਸੌਖੀ ਰੱਖਣਾ ਚਾਹੁੰਦੇ ਹਨ ਤਾਂ ਉਹ ਚਾਹੁੰਦੇ ਹਨ ਕੋਈ ਆਸਾਨ ਕੰਮ ਆਸਾਨ ਕਿੱਤਾ ਉਹਨਾਂ ਨੂੰ ਮਿਲ ਜਾਵੇ ਜਿਸ ਨਾਲ ਕਿ ਉਹ ਆਪਣਾ ਜੀਵਨ ਜਾਪਣ ਕਰ ਸਕਣ ਇਸ ਲਈ ਵਪਾਰ ਵਗੈਰਾ ਬਿਜਨਸ ਵਗੈਰਾ ਵਿੱਚ ਲੋਕ ਜ਼ਿਆਦਾ ਜਾ ਰਹੇ ਹਨ ਅਤੇ ਖੇਤੀਬਾੜੀ ਦੀ ਮਹੱਤਤਾ ਬਹੁਤ ਹੈ ਕਿਉਂਕਿ ਜੇਕਰ ਅੱਜ ਪੂਰੀ ਦੁਨੀਆ ਸੰਸਾਰ ਦੇ ਲੋਕ ਰੋਟੀ ਖਾ ਰਹੇ ਹਨ ਅਨਾਜ ਕਣਕ ਖਾ ਰਹੇ ਹਨ ਤਾਂ ਉਸਦਾ ਕਾਰਣ ਸਿਰਫ਼ ਅਤੇ ਸਿਰਫ਼ ਕਿਸਾਨ ਹਨ ਕਿਉਂਕਿ ਜੋ ਵੀ ਫਸਲਾਂ ਅਸੀਂ ਸਾਰੇ ਵਿਅਕਤੀ ਖਾਂਦੇ ਹਾਂ ਉਹ ਇੱਕ ਆਮ ਕਿਸਾਨ ਦੁਆਰਾ ਖੇਤਾਂ ਦੇ ਵਿੱਚ ਉਗਾਈਆਂ ਜਾਂਦੀਆਂ ਹਨ ਅਤੇ ਉਹਨਾਂ ਤੋਂ ਹੀ ਸਾਰੀ ਜਿਹੜੀ ਦੁਨੀਆਂ ਹੈ ਉਹਦਾ ਰੱਜ ਹੁੰਦਾ ਹੈ ਤਾਂ ਲੋਕਾਂ ਦੀ ਸਾਰਿਆਂ ਦੀ ਦੇਖਿਆ ਜਾਵੇ ਤਾਂ ਰੋਟੀ ਦਾ ਜੋ ਇੱਕ ਸਾਧਨ ਹੈ ਉਹ ਖੇਤੀਬਾੜੀ ਹੈ ਇਸ ਲਈ ਖੇਤੀਬਾੜੀ ਦੀ ਜਿਹੜੀ ਮਹੱਤਤਾ ਹੈਗੀ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਹੈ